ਹਾਂਜੀ ਬਿਲਕੁਲ ਅਸੀਂ ਆਪਣੇ ਮੋਬਾਈਲ 'ਤੇ ਨਿਊਜ਼ ਫੀਡ ਪੜ੍ਹਦੇ ਹਾਂ ਤਾਂ ਬਹੁਤ ਸਾਰੇ ਚੈਨਲਾਂ ਦੇ ਆਪਾਂ ਅਸੀਂ ਗਾਹਕ ਹੈਗੇ ਹਾਂ ਜਿਵੇਂ ਜੀ ਨਿਊਜ ਆਜ ਤੱਕ ਡੇਲੀ ਪੰਜਾਬੀ ਪੋਸਟ ਚਾਹੇ ਚੜ੍ਹਦੀ ਕਲਾ ਹੋਰ ਬਹੁਤ ਸਾਰੇ ਚੈਨਲ ਹੈ ਜਿਹਨਾਂ ਦੇ ਅਸੀਂ ਗਾਹਕ ਆ ਤਾਂ ਮੋਬਾਇਲ ਦੇ ਉੱਤੇ ਜਦੋਂ ਅਸੀਂ ਨਿਊਜ਼ ਫੀਡ ਪੜ੍ਹਦੇ ਹੈ ਤਾਂ ਅਲੱਗ ਅਲੱਗ ਚੈਨਲਾਂ ਦੇ ਉੱਤੇ ਪੜ੍ਹਨ ਦੇ ਨਾਲ ਸਾਨੂੰ ਅਲੱਗ ਅਲੱਗ ਚੈਨਲਾਂ ਦੀ ਕੀ ਸੋਚ ਹੈਗੀ ਹੈ ਉਹ ਕਿਸੇ ਨਿਊਜ਼ ਨੂੰ ਕਿਸ ਤਰੀਕੇ ਨਾਲ ਲੈਂਦੇ ਹੈ ਉਹਦਾ ਵੀ ਪਤਾ ਲੱਗਦਾ ਹੈਗਾ ਬਹੁਤ ਸਾਰੇ ਨਿਊਜ਼ ਚੈਨਲਾਂ ਨੂੰ ਅਸੀਂ ਸੁਣਦੇ ਹਾਂ ਬਹੁਤ ਸਾਰੇ ਨਿਊਜ਼ ਚੈਨਲਾਂ ਨੂੰ ਪੜ੍ਹਦੇ ਹਾਂ ਅਤੇ ਮੋਬਾਈਲ 'ਤੇ ਨਿਊਜ਼ ਫੀਡ ਪੜ੍ਹਦੇ ਹਾਂ ਤਾਂ ਉਹਦਾ ਇੱਕ ਫਾਇਦਾ ਇਹ ਹੁੰਦਾ ਕਿ ਸਾਨੂੰ ਤੁਰੰਤ ਜਾਣਕਾਰੀ ਮਿਲਦੀ ਹੈ ਅਸੀਂ ਨਿਊਜ਼ਪੇਪਰ ਜਦੋਂ ਅਖਬਾਰ ਪੜ੍ਹਦੇ ਹਾਂ ਤਾ ਉਹਦੀ ਸਾਨੂੰ ਉਦੋਂ ਜਾਣਕਾਰੀ ਅਗਲੇ ਦਿਨ ਮਿਲਦੀ ਹੈ ਜੇ ਜੇ ਕੋਈ ਅੱਜ ਘਟਨਾ ਘਟੀ ਹੈ ਤਾਂ ਉਹ ਕੱਲ੍ਹ ਨੂੰ ਅਖਬਾਰ 'ਚ ਆਉਂਦੀ ਹੈ ਲੇਕਿਨ ਨਿਊਜ਼ ਫੀਡ ਦੇ ਉੱਤੇ ਉਹ ਸੇਮ ਟਾਈਮ ਜਾਂ ਕੁਛ ਸਮੇਂ ਬਾਅਦ ਦਸ ਪੰਦਰ੍ਹਾਂ ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਇੱਕ ਜਾਂ ਦੋ ਘੰਟਿਆਂ ਬਾਅਦ ਹੀ ਸਾਨੂੰ ਉਹ ਜਿਹੜੀ ਜਾਣਕਾਰੀ ਹੈ ਉਹ ਮਿਲ ਜਾਂਦੀ ਹੈਗੀ ਹੈ ਤਾਂ ਨਿਊਜ਼ ਚੈਨਲਾਂ ਦਾ ਬਹੁਤ ਵੱਡਾ ਰੋਲ ਹੈਗਾ ਅੱਜ ਦੇ ਜਿਹੜੀ ਹੈ ਜਲਦਬਾਜੀ ਵਾਲੇ ਸਮਾਜ ਦੇ ਅੰਦਰ ਇਹ ਜਿਹੜਾ ਸਮਾਂ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈਗਾ ਤਾਂ ਇਸ ਸਮੇਂ ਨਿਊਜ਼ ਚੈਨਲਾਂ ਦਾ ਇੱਕ ਬਹੁਤ ਵੱਡਾ ਰੋਲ ਹੈਗਾ ਨਿਊਜ਼ ਫੀਡ ਦਾ ਇੱਕ ਬਹੁਤ ਵੱਡਾ ਰੋਲ ਹੈਗਾ ਤਾਂ ਅਸੀਂ ਬਹੁਤ ਸਾਰੇ ਨਿਊਜ਼ ਚੈਨਲਾਂ ਦੇ ਗਾਹਕ ਹਾਂ